ਸਾਡੇ ਜਿਲ੍ਹੇ ਵਿੱਚ ਕੁਝ ਪੂਜਾ ਸਥਾਨ ਹਨ ਜਿਵੇਂ ਕਿ ਰਾਮ ਤੀਰਥ ਬਾਬਾ ਦੀਪ ਸਿੰਘ ਸ਼ਹੀਦਾਂ ਸਾਹਿਬ ਗੋਲਡਨ ਟੈਂਪਲ ਆਦਿ ਹਨ ਸਾਡੇ ਜ਼ਿਲ੍ਹੇ ਵਿੱਚ ਪਰੰਪਰਾਵਾਂ ਅਤੇ ਤਿਉਹਾਰ ਹਰ ਭਾਈਚਾਰੇ ਦੇ ਲੋਕ ਰਲ ਮਿਲ ਕੇ ਮਨਾਉਂਦੇ ਹਨ ਜਿਵੇਂ ਕਿ ਰਾਮ ਤੀਰਥ ਦੇ ਵਿੱਚ ਰਾਮ ਨੌਮੀ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਅਤੇ ਗੋਲਡਨ ਟੈਂਪਲ ਵਿੱਚ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਸਾਰੇ ਹੀ ਧਰਮਾਂ ਦੇ ਲੋਕ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਮਨਾਉਂਦੇ ਹਨ ਅਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਜੇ ਅਸੀਂ ਸੱਭਿਆਚਾਰਕ ਪ੍ਰੰਪਰਾਵਾਂ ਦੀ ਗੱਲ ਕਰੀਏ ਤਾਂ ਲੋਹੜੀ ਦੀਵਾਲੀ ਅਤੇ ਵਿਸਾਖੀ ਦਾ ਤਿਉਹਾਰ ਵੀ ਬੜੇ ਪਿਆਰ ਦੇ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਸਾਰੇ ਭਾਈਚਾਰੇ ਦੇ ਲੋਕ ਰਲ ਮਿਲ ਕੇ ਬੈਠਦੇ ਹਨ ਅਤੇ ਗਿੱਧਾ ਭੰਗੜਾ ਪਾਉਂਦੇ ਹਨ ਅਤੇ ਜ਼ਿੰਦਗੀ ਨੂੰ ਬੜੇ ਸੋਹਣੇ ਢੰਗ ਨਾਲ ਬਤੀਤ ਕਰਦੇ ਹਨ